ਸਾਡੇ ਘਰ ਬਿਜਲੀ ਤਾਂ ਵੈਸੇ ਚੌਵੀ ਘੰਟੇ ਆਉਂਦੀ ਹੈ ਪਰ ਕਈ ਵਾਰ ਬਿਜਲੀ ਖਰਾਬ ਹੋਣ ਕਰਕੇ ਜਾਂ ਮੌਸਮ ਖਰਾਬ ਹੋਣ ਕਰਕੇ ਬਿਜਲੀ ਦੇ ਕੱਟ ਲੱਗਦੇ ਹਨ ਪਰ ਕੱਟ ਇੰਨੇ ਲੰਬੇ ਵੀ ਨਹੀਂ ਹੁੰਦੇ ਅੱਜ ਕੱਲ੍ਹ ਸਰਕਾਰਾਂ ਨੇ ਬਹੁਤ ਵਧੀਆ ਕੰਮ ਕੀਤਾ ਹੋਇਆ ਹੈ ਕਿ ਸਾਡੀ ਜਿਹੜੀ ਸ਼ਿਕਾਇਤ ਹੈ ਉਹ ਫੋਨ ਦੇ ਉੱਤੇ ਹੀ ਦਰਜ ਕਰ ਲਿੱਤੀ ਜਾਂਦੀ ਹੈ ਸਾਨੂੰ ਕਿੱਥੇ ਜਾਣਾ ਨਹੀਂ ਪੈਂਦਾ ਅਤੇ ਸਾਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਬਿਜਲੀ ਕਦੋਂ ਜਾਏਗੀ ਅਤੇ ਕਦੋਂ ਆਏਗੀ ਔਰ ਇਹਦਾ ਪਤਾ ਵੀ ਸਾਨੂੰ ਸਰਕਾਰ ਆਪਣੇ ਮੋਬਾਈਲ ਫੋਨਾਂ ਨਾਲ ਸਾਨੂੰ ਦਿੰਦੀ ਰਹਿੰਦੀ ਹੈ ਪਹਿਲਾਂ ਪਹਿਲਾਂ ਹੁੰਦਾ ਸੀ ਕੱਟ ਬਹੁਤ ਵੱਡੇ ਵੱਡੇ ਲੱਗਦੇ ਸਨ ਪਰ ਹੁਣ ਇੰਨੇ ਵੱਡੇ ਕੱਟ ਨਹੀਂ ਲੱਗਦੇ ਔਰ ਵੈਸੇ ਸਰਦੀਆਂ ਦੇ ਵਿੱਚ ਕੱਟ ਲੱਗੇ ਤਾਂ ਕੋਈ ਇੰਨਾਂ ਪ੍ਰਭਾਵ ਨਹੀਂ ਹੁੰਦਾ ਕਿਉਂਕਿ ਉਦੋਂ ਬਿਜਲੀ ਦੀ ਬਹੁਤ ਘੱਟ ਵਰਤੋਂ ਹੁੰਦੀ ਹੈ ਨਾ ਪੱਖੇ ਚਲਦੇ ਹਨ ਨਾ ਏਸੀ ਚਲਦੇ ਹਨ ਪਰ ਗਰਮੀਆਂ ਦੇ ਵਿੱਚ ਜਦੋਂ ਕੱਟ ਲੱਗਦਾ ਹੈ ਤਾਂ ਮਹਿਸੂਸ ਹੁੰਦਾ ਹੈ ਕਿ ਕੱਟ ਨਹੀਂ ਲੱਗਣੇ ਚਾਹੀਦੇ ਕਿਉਂਕਿ ਗਰਮੀਆਂ ਦੇ ਵਿੱਚ ਬਿਜਲੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਸਾਡੇ ਵਾਸਤੇ ਔਰ ਸਾਨੂੰ ਹਲਕਾ ਜਿਹਾ ਵੀ ਜਦੋਂ ਕੱਟ ਵਿੱਚ ਗਰਮੀਆਂ ਦੇ ਵਿੱਚ ਕੱਟ ਲੱਗਦਾ ਹੈ ਤਾਂ ਸਾਨੂੰ ਬਹੁਤ ਪਰੇਸ਼ਾਨੀ ਮਹਿਸੂਸ ਹੁੰਦੀ ਹੈ ਪਰ ਫਿਰ ਵੀ ਅੱਗੇ ਨਾਲੋਂ ਇਹ ਕੱਟ ਕੱਟ ਲੱਗਦੇ ਹਨ ਅਤੇ ਹੁਣ ਜ਼ਿਆਦਾ ਸਹੂਲਤਾਂ ਵੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਇਸ ਕਰਕੇ ਕੱਟ ਜਿਹੜੇ ਹਨ ਉਹ ਸਾਨੂੰ ਇੰਨਾਂ ਇਫੈਕਟ ਨਹੀਂ ਕਰਦੇ